ਹਰੇਕ ਜ਼ਮਾਨੇ ਵਿੱਚ ਕਿੱਤੇ ਦੇ ਨਵੇਂ ਨਵੇਂ ਰੂਪ ਉਪਜਦੇ ਹਨ ਜੋ ਕਿ ਲੋਕਾਂ ਦੀਆਂ ਲੋੜਾਂ ਦੇ ਅਨੁਸਾਰ ਹੁੰਦੇ ਹਨ ਕਿਸ ਨੂੰ ਕਮਾਈ ਦਾ ਸਾਧਨ ਵੀ ਕਿਹਾ ਜਾਂਦਾ ਹੈ ਅੱਜ ਕੱਲ੍ਹ ਇੱਕ ਨਵਾਂ ਕਿੱਤਾ ਵੀ ਉੱਭਰ ਕੇ ਆ ਰਿਹਾ ਹੈ ਅੱਜ ਕੱਲ੍ਹ ਸਾਡੇ ਆਲੇ ਦੁਆਲੇ ਬਹੁਤ ਸਾਰੇ ਲੋਕ ਆਪਣੇ ਘਰਾਂ ਨੂੰ ਹੋਮ ਸਟੇਅ ਜਾਂ ਪੀਜੀ ਬਣਾ ਲੈਂਦੇ ਹਨ ਜਿਸ ਵਿੱਚ ਕਈ ਵਾਰ ਖਾਣ ਪੀਣ ਖਾਣ ਪੀਣ ਵੀ ਨਾਲ ਹੀ ਦਿੱਤਾ ਜਾਂਦਾ ਹੈ ਇਸ ਨਾਲ ਅੱਜ ਕੱਲ੍ਹ ਘਰਾਂ ਵਿੱਚ ਬੈਠੀਆਂ ਔਰਤਾਂ ਕਮਾਈ ਕਰ ਸਕਦੀਆਂ ਹਨ ਹੋਮ ਸਟੇਅ ਮਹਿੰਗੇ ਮਹਿੰਗੇ ਹੋਟਲਾਂ ਹੋਟਲਾਂ ਨਾਲੋਂ ਬਹੁਤ ਵਧੀਆ ਹੁੰਦੇ ਹਨ ਕਿਉਂਕਿ ਹੋਮ ਸਟੇਅ ਵਿੱਚ ਵਿਅਕਤੀ ਦੇ ਘਰ ਵਾਲਾ ਹੀ ਮਾਹੌਲ ਹੁੰਦਾ ਹੈ ਪਰੰਤੂ ਇਸ ਦੇ ਉਲਟ ਜੇਕਰ ਦੇਖੀਏ ਤਾਂ ਇਸ ਦੇ ਕਈ ਨੁਕਸਾਨ ਵੀ ਹਨ ਅਸੀਂ ਆਪਣੇ ਘਰਾਂ ਹੋਮ ਸਟੇਅ ਵਿੱਚ ਮੁੰਡਿਆਂ ਨੂੰ ਰੱਖ ਰੱਖ ਲੈਂਦੇ ਹਾਂ ਜੋ ਕਿ ਸਰਾਬਾਂ ਨਸ਼ੇ ਆਦਿ ਪੀ ਕੇ ਆਪਣੇ ਹੋਮ ਸਟੇਅ ਵਿੱਚ ਆ ਜਾਂਦੇ ਨੇ ਅਤੇ ਉੱਥੇ ਆ ਕੇ ਗਲਤ ਬੋਲਦੇ ਹਨ ਗਾਲ੍ਹਾਂ ਕੱਢਦੇ ਹਨ ਅਤੇ ਘਰ ਦੇ ਸਮਾਨ ਦੀ ਤੋੜ ਫੋੜ ਕਰ ਦਿੰਦੇ ਹਨ ਸਾਡੇ ਘਰਾਂ ਵਿੱਚ ਮਾਵਾਂ ਧੀਆਂ ਹੁੰਦੀਆਂ ਹਨ ਜੋ ਕਿ ਉਹਨਾਂ ਦੇ ਸਾਹਮਣੇ ਸਭ ਕੁਝ ਚੰਗਾ ਨਹੀਂ ਲੱਗਦਾ ਇਹਨਾਂ ਵਿੱਚ ਕੁਝ ਕ ਲੋਕ ਹੁੰਦੇ ਹਨ ਜੋ ਕਿ ਆਪਣੇ ਹੋਮ ਸਟੇਅ ਦਾ ਖਰਚਾ ਨਹੀਂ ਦਿੰਦੇ ਅਤੇ ਇਸੇ ਤਰ੍ਹਾਂ ਭੱਜ ਜਾਂਦੇ ਆ ਇੰਨੇ ਸਭ ਚੀਜ਼ਾਂ ਨੂੰ ਦੇਖਦੇ ਹੋਏ ਅੱਜ ਕੱਲ੍ਹ ਕਿ ਲੋਕਾਂ ਨੇ ਆਪਣੇ ਹੋਮ ਸਟੇਅ ਹੀ ਬੰਦ ਕਰ ਲਏ ਹਨ ਅਤੇ ਕਈ ਲੋਕਾਂ ਨੇ ਮੁੰਡਿਆਂ ਨੂੰ ਹੋਮ ਸਟੇਅ ਦੇਣੇ ਹੀ ਬੰਦ ਕਰ ਦਿੱਤੇ ਹਨ